ਪੰਜਾਬ ਦੇ ਵਿੱਚ ਬਹੁਤ ਸਾਰੀਆਂ ਜਿਹੜੀਆਂ ਸਿਹਤ ਸਹੂਲਤਾਂ ਇਸ ਵੇਲੇ ਉਪਲੱਬਧ ਹੈਗੀਆਂ ਕੋਈ ਸਮਾਂ ਸੀ ਜਦੋਂ ਜਣੇਪੇ ਦੇ ਵਿੱਚ ਜਿਹੜੀਆਂ ਔਰਤਾਂ ਹੁੰਦੀਆਂ ਸੀ ਉਹ ਘਰਾਂ ਦੇ ਵਿੱਚ ਵਿਚਾਰੀਆਂ ਮਤਲਬ ਪੁਰਾਣੀਆਂ ਦਾਈਆਂ ਦੇ ਰਾਹੀਂ ਜਦੋਂ ਉਹ ਬੱਚਾ ਪੈਦਾ ਕਰਦੀਆਂ ਸੀ ਤਾਂ ਬਹੁਤ ਸਾਰੇ ਬੱਚਿਆਂ ਦੀ ਮੌਤ ਹੋ ਜਾਂਦੀ ਸੀ ਬਹੁਤ ਸਾਰੀਆਂ ਔਰਤਾਂ ਨੂੰ ਸਮੱਸਿਆਵਾਂ ਆਉਂਦੀਆਂ ਸੀ ਕਈ ਵਾਰ ਉਹਨਾਂ ਨੂੰ ਅਸੀਂ ਕਚੀਰ ਬੋਲਦੇ ਸੀ ਜਿਹੜੇ ਔਰਤ ਬੱਚੇ ਪੈਦਾ ਕਰਦੇ ਸਨ ਮਰ ਜਾਂਦੇ ਸੀ ਤਾਂ ਇਸ ਤਰ੍ਹਾਂ ਦੀ ਦਿੱਕਤ ਆਉਂਦੀ ਸੀ ਪਰ ਅੱਜ ਔਰਤਾਂ ਨੂੰ ਇੱਕ ਸੌ ਅੱਠ ਨੰਬਰ ਵੈਨ ਦੇ ਉੱਤੇ ਘਰ ਤੋਂ ਲਿਜਾਇਆ ਜਾਂਦਾ ਅਤੇ ਘਰ ਛੱਡਿਆ ਜਾਂਦਾ ਅਤੇ ਬਕਾਇਦਾ ਉਹਨਾਂ ਨੂੰ ਜਣੇਪੇ ਦੀ ਇੱਕ ਵਿਸ਼ੇਸ਼ ਸਹਾਇਤਾ ਰਾਸ਼ੀ ਦਿੱਤੀ ਜਾਂਦੀ ਹੈ ਉਹਨਾਂ ਦੇ ਲਈ ਖਾਸ ਤੌਰ ਦੇ ਉੱਤੇ ਜਿਹੜੀਆਂ ਪਿੰਡਾਂ ਦੇ ਵਿੱਚ ਸਿਹਤ ਕੇਂਦਰ ਬਣੇ ਹੋਏ ਉਹਨਾਂ 'ਚ ਏ ਐਨ ਐਮ ਜਿਹੜੀਆਂ ਨਰਸਾਂ ਹੈਗੀਆਂ ਉਹ ਉਸ ਤੋਂ ਬਿਨਾ ਆਸ਼ਾ ਵਰਕਰਸ ਹੈਗੀਆਂ ਜਿਹੜੀਆਂ ਉਹਨਾਂ ਨੂੰ ਸਮੇਂ ਸਮੇਂ 'ਤੇ ਟ੍ਰੀਟਮੈਂਟ ਕਰਦੀਆਂ ਆਂਗਣਵਾੜੀ ਵਰਕਰ ਆ ਉਹਨਾਂ ਨੂੰ ਸਮੇਂ ਸਮੇਂ 'ਤੇ ਜਿਹੜੀਆਂ ਉਹ ਭੋਜਨ ਦੀ ਸਹੂਲਤ ਉਹ ਦਿੰਦੀਆਂ ਹੈਗੀਆਂ ਤਾਂ ਇਸ ਤਰ੍ਹਾਂ ਬਹੁਤ ਸਾਰੀਆਂ ਸਹੂਲਤਾਂ ਲੋਕਾਂ ਨੂੰ ਮਿਲ ਰਹੀਆਂ ਹੁਣ ਤਾਂ ਪੰਜਾਬ ਸਰਕਾਰ ਨੇ ਪੰਜਾਬ ਦੇ ਵਿੱਚ ਮੁਹੱਲਾ ਕਲੀਨਿਕ ਵੀ ਬਣਾਏ ਜਿੱਥੇ ਲੋਕਾਂ ਨੂੰ ਬਹੁਤ ਸਾਰੀਆਂ ਸਹੂਲਤਾਂ ਮਿਲਦੀਆਂ ਉੱਥੇ ਇੱਕ ਬੀ ਏ ਐਮ ਐਸ ਆਯੂਰਵੇਦਿਕ ਡਾਕਟਰ ਵੀ ਬਿਠਾਇਆ ਜਾ ਰਿਹਾ ਜਿਨਾਂ ਨੂੰ ਸੀ ਐਚ ਓ ਦਾ ਨਾਮ ਦਿੱਤਾ ਗਿਆ ਅਤੇ ਉਹ ਜੀ ਐਨ ਐਮ ਦਾ ਕੋਰਸ ਕੀਤਾ ਹੋਇਆ ਉਹ ਜਿਹੜੀਆਂ ਲੜਕੀਆਂ ਸੀ ਐਚ ਓ ਕਮਿਊਨਿਟੀ ਹਾਲ ਦਫ਼ਤਰ ਬੋਲਿਆ ਜਾਂਦਾ ਉਹਨਾਂ ਨੂੰ ਉਹ ਵੀ ਉੱਥੇ ਹੁੰਦੀਆਂ ਅਤੇ ਲੋਕਾਂ ਨੂੰ ਕਾਫ਼ੀ ਅੱਛੀਆਂ ਸਹੂਲਤਾਂ ਮਿਲ ਰਹੀਆਂ ਹੈਗੀਆਂ ਅਤੇ ਹਰ ਰੋਗ ਹਰ ਰੋਗ ਦੇ ਲਈ ਲੋਕਾਂ ਨੂੰ ਕਾਫ਼ੀ ਅੱਛੀਆਂ ਸਿਹਤ ਸਹੂਲਤਾਂ ਤਾਂ ਪੰਜਾਬ ਸਰਕਾਰ ਦਾ ਇਹ ਯੋਗ ਉਪਰਾਲਾ